ਹਾਂਜੀ ਅਖ਼ਬਾਰਾਂ ਦੇ ਵਿੱਚ ਬੱਚਿਆਂ ਦੇ ਲਈ ਇੱਕ ਸਪੈਸ਼ਲ ਕੋਲਮ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਬੱਚਿਆਂ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਗੇਮਜ਼ ਬਾਰੇ ਦੱਸਿਆ ਜਾਂਦਾ ਹੈ ਬੱਚਿਆਂ ਦੇ ਬੱਚਿਆਂ ਦੇ ਹੋਬੀਜ਼ ਬਾਰੇ ਦੱਸਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਕਿਹੜੀਆਂ ਖੇਡਾਂ ਪਸੰਦ ਹੈ ਜਾਂ ਕਿਹੜਾ ਸੰਗੀਤ ਪਸੰਦ ਹੈ ਉਹਨਾਂ ਲਈ ਅਲੱਗ ਕੋਲਮ ਬਣਾਇਆ ਜਾਂਦਾ ਹੈ ਜਿਹਦੇ ਨਾਲ ਬੱਚੇ ਉਹਨਾਂ ਨੂੰ ਪੜ੍ਹ ਕੇ ਜਾਂ ਹਾਸੇ ਮਜ਼ਾਕ ਦੇ ਕੋਈ ਚੁਟਕਲੇ ਉਹਦੇ ਵਿੱਚ ਹੁੰਦੇ ਆ ਅਤੇ ਉਹਨਾਂ ਨੂੰ ਦੇਖਣਾ ਅਤੇ ਸੁਣਨਾ ਪਸੰਦ ਕਰਦੇ ਹਨ